ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਠੀਕ ਰੋਪੜ ਤੋਂ ਦਿੱਲੀ ਜਾਣ ਵਾਲੀ ਟਰੇਨ ਇੱਕੋ ਹੀ ਟਰੇਨ ਹੈ ਜਿਹੜੀ ਕਿ ਸਵੇਰੇ ਛੇ ਵਜੇ ਚ ਰੋਪੜ ਤੋਂ ਚੱਲਦੀ ਹੈ ਅਤੇ ਪੂਰੇ ਬਾਰ੍ਹਾਂ ਵਜੇ ਤੁਹਾਨੂੰ ਦਿੱਲੀ ਪਹੁੰਚਾ ਦੇਗੀ ਹਾਂਜੀ ਮਿਲ ਸਕਦੀ ਹੈ ਅਗਰ ਤੁਸੀਂ ਜੇ ਤਾਂ ਤੁਸੀਂ ਜਰਨਲ ਔਰ ਫਸਟ ਕਲਾਸ 'ਚ ਟਿਕਟ ਮੈਂ ਲੈਣੀ ਹੈ ਤਾਂ ਤੁਹਾਨੂੰ ਡਰੈਕਟ ਸਟੇਸ਼ਨ ਤੋਂ ਮਿਲ ਜੇਗੀ ਜੇਕਰ ਤੁਸੀਂ ਏਸੀ ਡੱਬਾ ਲੈਣਾ ਤਾਂ ਤੁਹਾਨੂੰ ਉਹਦੇ ਲਈ ਪਹਿਲਾਂ ਹੀ ਬੁਕਿੰਗ ਕਰਾਉਣੀ ਪਏਗੀ ਔਨਲਾਈਨ ਬੁਕਿੰਗ ਬਹੁਤ ਸਾਰੇ ਐਪ ਹੈ ਜਿੱਦਾਂ ਲਾਈਵ ਟ੍ਰੇਨ ਐਪ ਹੈ ਉਹ ਤੋਂ ਤੁਸੀਂ ਔਨਲਾਈਨ ਬੁਕਿੰਗ ਕਰਵਾ ਸਕਦੇ ਹੋ ਉਹਦੇ 'ਤੇ ਉਹਦੇ 'ਤੇ ਆਪਣੀਆਂ ਪੂਰੀ ਜਾਣਕਾਰੀ ਆਪਣਾ ਨਾਮ ਅਤੇ ਆਪਣਾ ਪੂਰਾ ਤਰੀਕ ਤੁਸੀਂ ਜਾਣਾ ਉਹ ਸਾਰਾ ਲਿਖ ਕੇ ਤੁਸੀਂ ਔਨਲਾਈਨ ਬੁਕਿੰਗ ਕਰਵਾ ਸਕਦੇ ਹੋ ਧੰਨਵਾਦ